ਹਾਂਜੀ ਮੈਂ ਸਾਡੇ ਏਰੀਏ ਦੇ ਵਿੱਚ ਪਟਿਆਲੇ ਦਾ ਸਭ ਤੋਂ ਫੇਮਸ ਰਜਿੰਦਰਾ ਮੈਡੀਕਲ ਜਿਹੜਾ ਕੋਲੇਜ ਐਂਡ ਹੋਸਪੀਟਲ ਮੈਂ ਉੱਥੇ ਜਾਂਦੀ ਰਹਿੰਦੀ ਹਾਂ ਹੋਸਪੀਟਲ ਦੇ ਵਿੱਚ ਜਿਹੜਾ ਮੇਰਾ ਡੇਲੀ ਦਾ ਜਿਹੜਾ ਜੋ ਵੀ ਚੈੱਕਅਪ ਹੁੰਦਾ ਮੰਥਲੀ ਮੈਂ ਉਹ ਚੈੱਕਅਪ ਲਈ ਜਾਂਦੀ ਹਾਂ ਤਾਂ ਦਿਨ ਬੇ ਦਿਨ ਜਿਹੜੀ ਉਹਦੀ ਕ ਹਾਲਤ ਉਹ ਸੁਧਰ ਰਹੀ ਹੈ ਸਰਕਾਰਾਂ ਨੇ ਨਵੀਆਂ ਪੋਲਸੀਆਂ ਦੇ ਨਾਲ਼ ਉੱਥੇ ਕਾਫ਼ੀ ਸਿਸਟਮ ਨੂੰ ਜਿਹੜਾ ਚੇਂਜ ਕੀਤਾ ਨਵੀਆਂ ਬਿਲਡਿੰਗਸ ਬਣੀਆਂ ਐਕਸਰੇ ਮਸ਼ੀਨਾਂ ਅਲਟਰਾ ਸਾਊਂਡ ਮਸ਼ੀਨਾਂ ਉਹ ਬਹੁਤ ਮਤਲਬ ਕਿ ਨਵੀਆਂ ਲਗਾਈਆਂ ਗਈਆਂ ਡਾਕਟਰ ਬਹੁਤ ਵਧੀਆ ਆਏ ਆ ਜਿਹੜੇ ਹੈਲਪ ਕਰਦੇ ਹੈ ਦਿਨ ਬੇ ਦਿਨ ਇਹਨਾਂ ਦੀ ਹਾਲਤ 'ਚ ਮੈਂ ਕਾਫ਼ੀ ਸੁਧਾਰ ਦੇਖਿਆ ਅਤੇ ਜੇ ਸਾਨੂੰ ਉੱਥੇ ਹਰ ਫੈਸਿਲਿਟੀ ਮਿਲ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰੀ ਹੋਸਪੀਟਲ ਦੇ ਵਿੱਚ ਜਿਹੜਾ ਇਲਾਜ ਉਹ ਬਹੁਤ ਘੱਟ ਫੀਸ 'ਤੇ ਹੁੰਦਾ ਅਤੇ ਕਈਆਂ ਦਾ ਇਲਾਜ ਹੈ ਜਿਹੜਾ ਉਹ ਬਿਲਕੁਲ ਫ੍ਰੀ ਵੀ ਹੁੰਦਾ ਦਵਾਈਆਂ ਬਹੁਤ ਘੱਟ ਰੇਟ 'ਤੇ ਮਿਲਦੀਆਂ